ਅਸੀਂ ਬਾਹਰ ਜਾਂਦੇ ਹਾਂ ਸਾਡੀ ਸਾਡਾ ਧਿਆਨ ਸਾਡੇ ਪੜੌਸੀ ਨੇ ਜਿਹੜੇ ਉਹ ਬਹੁਤ ਅੱਛੀ ਤਰ੍ਹਾਂ ਕਰਦੇ ਨੇ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਹੁਣ ਵੀ ਸਾਡੇ ਬੂਟੇ ਸੁੱਕ ਜਾਣਗੇ ਕੋਈ ਇਸ ਇਹਨਾਂ ਨੂੰ ਵੱਢ ਜਾਵੇਗਾ ਕੋਈ ਸਬਜ਼ੀ ਲੈ ਕੇ ਚਲੇ ਜਾਵੇਗਾ ਇਹ ਸਾਨੂੰ ਕੋਈ ਫਿਕਰ ਨਹੀਂ ਰਹਿੰਦਾ ਸਾਡੇ ਪੜੋਸੀ ਬਹੁਤ ਚੰਗੇ ਨੇ ਅਸੀਂ ਉਹਨਾਂ ਦੇ ਸਹਾਰੇ 'ਤੇ ਸਭ ਕੁਛ ਛੱਡ ਕੇ ਜਾਂਦੇ ਹਾਂ ਪਾਣੀ ਦਿੰਦੇ ਹੈ ਗੋਡੀਆਂ ਕਰਦੇ ਨੇ ਸਾਂਭ ਉਹਨਾਂ ਦੀ ਬਹੁਤ ਕਰਦੇ ਬੂਟਿਆਂ ਦੀ ਇਸ ਵਾਸਤੇ ਅਸੀਂ ਬੇਫਿਕਰੇ ਹੋ ਕੇ ਚਲੇ ਜਾਂਦੇ ਹਾਂ

ਸਬਜ਼ੀਆਂ ਪੱਕ ਜਾਣ ਲਾਹ ਕੇ ਰੱਖ ਛੱਡਦੇ ਨੇ ਕੁਛ ਵੇਚ ਛੱਡਦੇ ਨੇ ਅਸੀਂ ਉਹਨਾਂ ਨੂੰ ਕਿਹਾ ਹੋਇਆ ਫੇਰ ਸਾਡਾ ਕੋਈ ਨੁਕਸਾਨ ਨਹੀਂ ਹੁੰਦਾ ਬਾਅਦ 'ਚ